ਪੰਜਾਬੀ ਭਾਸ਼ਾ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤਰ੍ਹਾਂ ਕਿ ਅੰਗਰੇਜ਼ੀ ਹਿੰਦੀ ਸਾਰੀਆਂ ਭਾਸ਼ਾ ਉੱਪਰ ਨੇ ਹੁਣ ਪੰਜਾਬੀ ਨੂੰ ਪਹਿਲਾਂ ਸਭ ਤੋਂ ਪਹਿਲਾਂ ਉ ਉੱਚ ਉੱਚੀ ਥਾਂ 'ਤੇ ਰੱਖਿਆ ਜਾਂਦਾ ਸੀ ਪਰ ਹੁਣ ਦੇ ਸਮੇਂ ਵਿੱਚ ਪੰਜਾਬੀ ਨੂੰ ਤਾਂ ਖਤਮ ਹੀ ਕੀਤਾ ਜਾ ਰਿਹਾ ਹੈ ਜ਼ਿਆਦਾਤਰ ਕਿ ਪ੍ਰਾਈਵੇਟ ਸਕੂਲ ਵਾਲੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਨੂੰ ਨਹੀਂ ਇੰਗਲਿਸ਼ ਨੂੰ ਹੀ ਜ਼ਰੂਰੀ ਮੰਨਿਆ ਜਾਂਦਾ ਹੈ ਕਈ ਸਾਲਾਂ ਤੱਕ ਤਾਂ ਛੋਟੇ ਬੱਚਿਆਂ ਨੂੰ ਪੰਜਾਬੀ ਦੇ ਬਾਰੇ ਕੁਛ ਦੱਸਿਆ ਸਮਝਾਇਆ ਹੀ ਨਹੀਂ ਜਾਂਦਾ ਪੜ੍ਹਾਇਆ ਹੀ ਨਹੀਂ ਜਾਂਦਾ ਅਤੇ ਪ੍ਰਾਈ ਸਰਕਾਰੀ ਸਕੂਲਾਂ ਵਿੱਚ ਫਿਰ ਵੀ ਪੰਜਾਬੀ ਦੀ ਕਲਾਸ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਦਿੱਤੀ ਗਈ ਹੈ ਜਿਹਦੇ ਵਿੱਚ ਅੱਜ ਦੀ ਸਰਕਾਰ ਨੇ ਵੀ ਕਾਫੀ ਜਿੱਦਾਂ ਕਿ ਪੰਜਾਬੀ ਨੂੰ ਸਭ ਤੋਂ ਉੱਪਰ ਰੱਖਿਆ ਹੈ ਪਰ ਉਹਨਾਂ ਨੇ ਜੁਰਮਾਨੇ ਸਰਕਾਰੀ ਸਕੂਲ ਲ ਅੱਜ ਹੁਣ ਅਤੇ ਹੁਣ ਥੋੜ੍ਹਾ ਬਹੁਤ ਸਰਕਾਰਾਂ ਨੇ ਜਿਹੜਾ ਪੰਜਾਬੀ ਨਹੀਂ ਲੱਗਦੀ ਕਲਾਸਾਂ ਸਕੂਲਾਂ 'ਚ ਪੜ੍ਹਾਈ ਜਾਂਦੀ ਉਹਦੇ 'ਤੇ ਜੁਰਮਾਨਾ ਤਾਂ ਰੱਖਿਆ ਪਰ ਪ੍ਰਾਈਵੇਟ ਸਕੂਲ ਵਾਲਾ ਵਾਲਿਆਂ ਦੀਆਂ ਫੀਸਾਂ ਹੀ ਬਹੁਤ ਨੇ ਜੇ ਉਹ ਜੁਰਮਾਨਾ ਭਰ ਵੀ ਲੈਂਦੇ ਨੇ ਤਾਂ ਦੁਬਾਰਾ ਜ਼ਿਆਦਾ ਫੀਸਾਂ ਲੈ ਕੇ ਬੱਚਿਆਂ ਕੋਲੋਂ ਕੱਢ ਲੈਂਦੇ ਨੇ ਪਰ ਸਾਡੇ ਸਮੇਂ ਵਿੱਚ ਪੰਜਾਬੀ ਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਸੀ ਪਰ ਹੌਲੀ ਹੌਲੀ ਲੱਗਦਾ ਹੈ ਕਿ ਪੰਜਾਬੀ ਅਲੋਪ ਹੀ ਹੁੰਦੀ ਜਾਵੇਗੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਹੋਏਗਾ ਕਿ ਪੰਜਾਬੀ ਨੂੰ ਬੋਲਣਾ ਕਿੱਦਾਂ ਅਤੇ ਲਿਖਣਾ ਕਿਸ ਤਰ੍ਹਾਂ ਹੈ ਜਿਹੜੇ ਅੱਜ ਦੇ ਬੱਚੇ ਨੇ ਜੇ ਉਹਨਾਂ ਨੂੰ ਸਕੂਲ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਜੇ ਉਹਨਾਂ ਦੇ ਮਾਂ ਪਿਉ ਵੀ ਸਕੂਲ ਵਿੱਚ ਜਾਂਦੇ ਨੇ ਮੀਟਿੰਗਾਂ 'ਤੇ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਵਿੱਚ ਗੱਲ ਕਰੋ ਪਰ ਸਾਨੂੰ ਹੁਣ ਅੱਜ ਦੇ ਸਮੇਂ ਵਿੱਚ ਅੰਗਰੇਜ਼ੀ ਕਿੱਥੋਂ ਆਉਣੀ ਹੈ ਅਸੀਂ ਤਾਂ ਬਿਲਕੁਲ ਸਿੱਧੇ ਸਾਦੇ ਅਨਪੜ੍ਹ ਲੋਕ ਹਾਂ ਸਾਨੂੰ ਪੰਜਾਬੀ ਹੀ ਬੋਲਣੀ ਆਉਂਦੀ ਹੈ ਇਸ ਲਈ ਅਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਬੱਚਿਆਂ ਨੂੰ ਘਰਾਂ ਵਿੱਚ ਵੀ ਅੰਗਰੇਜ਼ੀ ਬੋਲਣ ਨੂੰ ਕਿਹਾ ਜਾਂਦਾ ਹੈ ਮਾਂ ਪਿਉ ਨੂੰ ਕਿਹਾ ਜਾਂਦਾ ਕਿ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਹੀ ਗੱਲ ਕਰੋ ਪਰ ਅਸੀਂ ਪੁਰਾਣੇ ਸਮੇਂ ਦੇ ਲੋਕ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਇਸ ਲਈ ਮੇਰੀ ਇਹ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਰਿਆਂ ਨੂੰ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਸਰਕਾਰਾਂ ਨੂੰ ਪੰਜਾਬੀ ਭਾਸ਼ਾ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਔਂ ਹਾ ਸਾਨੂੰ ਇਸ ਨੂੰ ਭੁਲਾਉਣਾ ਨਹੀਂ ਚਾਹੀਦਾ ਸਭ ਤੋਂ ਉੱਪਰ ਮਾਤ ਭਾਸ਼ਾ ਨੂੰ ਰੱਖ ਕੇ ਸਾਰੀਆਂ ਹੀ ਭਾਸ਼ਾ ਵਧੀਆ ਨੇ ਸਾਰਿਆਂ ਨੂੰ ਹੀ ਸਤਿਕਾਰ ਦੇਣਾ ਚਾਹੀਦਾ ਹੈ ਪਰ ਜੋ ਸਾਡੀ ਮਾਤ ਭਾਸ਼ਾ ਸਾਡੀ ਪੁਰਾਣੀ ਭਾਸ਼ਾ ਹੈ ਜੋ ਕਿ ਪਰ ਅਸੀਂ ਵੀ ਆਪਣੇ ਪੋਤਿਆਂ ਪੋਤੀ ਪੋਤੀਆਂ ਰਾਹੀਂ ਪੰਜਾਬੀ ਭਾਸ਼ਾ ਨਾਲ ਗੱਲ ਕਰਨ ਵਿੱਚ ਹੀ ਸਾਨੂੰ ਸੁਖਾਲਾ ਹੈ ਸਾਡੇ ਵਾਸਤੇ ਅੰਗਰੇਜ਼ੀ ਭਾਸ਼ਾ ਬੋਲਣੀ ਅਤੇ ਸੁਣਨੀ ਸਮਝਣੀ ਬਹੁਤ ਮੁਸ਼ਕਲ ਕੰਮ ਹੈ ਇਸ ਲਈ ਸਾਨੂੰ ਪੰਜਾਬੀ ਭਾਸ਼ਾ ਨੂੰ ਜਿਉਂਦੇ ਰੱਖਣਾ ਚਾਹੀਦਾ ਹੈ ਅਤੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਸਕਣ